ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੈਟਰਿੰਗ ਕੈਟਰਿੰਗ ਵਾਲੇ ਬੋਲਦੇ ਹੋ ਜੀ ਅਸੀਂ ਕੈਟਰਿੰਗ ਦਾ ਕੰਮ ਕਰਵਾਉਣਾ ਸੀ ਸਾਡੀ ਗੁੱਡੀ ਦਾ ਵਿਆਹ ਹੈ ਜੀ ਹੈਗਾ ਹੈ ਜੀ ਪੰਜ ਸੱਤ ਕੁ ਦਿਨ ਤੱਕ ਹਾਂ ਪੱਚੀ ਤਰੀਕ ਦਾ ਵਿਆਹ ਪੱਚੀ ਤਰੀਕ ਦਾ ਹਾਂਜੀ ਹਾਂਜੀ ਕਿੰਨੇ ਕੁ ਪੈਸੇ ਲੱਗਣਗੇ ਜੀ ਕਿੰਨੇ ਕੁ ਪੈਸੇ ਖ਼ਰਚਾ ਇਹ ਅਸੀਂ ਜਿੱਦਾ ਕਿ ਪੰਜ ਕੁ ਲੱਖ ਰੁਪਈਏ ਦਾ ਖ਼ਰਚਾ ਹੋਵੇ ਬੱਸ ਇਹਤੋਂ ਵੱਧ ਨਹੀਂ ਕਰ ਸਕਦੇ ਅਸੀਂ ਠੀਕ ਹੈ ਜੀ ਕੀ ਕੀ ਬਣਾਉਗੇ ਜੀ ਕੀ ਕੀ ਬਣਾਉਗੇ ਉਹਦੇ ਵਿੱਚ ਤੁਸੀਂ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਟੈਂ ਟੈਂਟ ਟੁਟ ਦਾ ਕਿੱਦਾਂ ਜੀ ਡੈਕੋਰੇਸ਼ਨ ਦਾ ਕਿੱਦਾਂ ਕੁ ਡੈਕੋ ਅੱਛਾ ਜੀ ਅੱਛਾ ਜੀ ਅੱਛੀ ਠੀਕ ਹੈ ਜਾਣੀ ਵਧੀਆ ਹੋਵੇ ਕੰਮ ਵਧੀਆ ਹੋਵੇ ਠੀਕ ਹੈ ਜੀ ਓਕੇ